ਚਿੱਤਰਕਾਰੀ ਕਰਦੇ ਸਮੇਂ ਮੈਂ ਕਾਫੀ ਤਰ੍ਹਾਂ ਦੀ ਸਪਲਾਈ ਦੀ ਵਰਤੋਂ ਕਰਦਾ ਹਾਂ ਜਿਵੇਂ ਕਰੀਓਨਸ ਪੈਂਸਿਲ ਕਲਰ ਔਇਲ ਪਿਸਟਲ ਅਤੇ ਪੈਨ ਬਰੱਸ਼ ਵਗੈਰਾ ਇਸ ਤੋਂ ਇਲਾਵਾ ਮੈਂ ਕਾਫੀ ਵਧੀਆ ਬ੍ਰਾਂਡ ਦੇ ਵੀ ਵਰ ਚੀਜ਼ਾਂ ਵਰਤਦਾ ਹਾਂ ਜਿਵੇਂ ਫੇਵਰ ਕੈਸਲ ਕੈਮਲੇਨ ਅਫਸਰਾ ਸਭ ਤੋਂ ਵਧੀਆ ਮੈਨੂੰ ਆਊਟਲਾਈਨ ਮਾਰਕਰ ਲੱਗਦੇ ਹਨ ਇਸ ਨਾਲ ਮੈਂ ਆਪਣੀ ਚਿੱਤਰਕਾਰੀ ਦੇ ਵਿੱਚ ਜੋ ਵੀ ਚੀਜ਼ਾਂ ਬਣਾਈਆਂ ਹੋਈਆਂ ਆ ਉਸ ਨੂੰ ਵਧੀਆ ਤਰੀਕੇ ਨਾਲ ਆਊਟਲਾਈਨ ਕਰਕੇ ਵੱਖਰਾ ਦਿਖਾ ਸਕਦਾ ਹਾਂ ਆਊਟਲਾਈਨ ਮਾਰਕਰ ਦਾ ਕੰਮ ਮੈਂ ਆਊਟਲਾਈਨਿੰਗ ਲਈ ਕਰਦਾ ਹਾਂ ਜਿਸ ਨਾਲ ਮੇਰੀ ਚੀਜ਼ ਵਧੀਆ ਲੱਭੇ ਉਸ ਦੇ ਵਿੱਚ ਫਿਰ ਮੈਂ ਫੈਬਰ ਕੈਸਲ ਦੇ ਪੈਨਸ਼ਲ ਕਲਰ ਅਤੇ ਕਰੀਓਨਸ ਵਰਤਦਾ ਹਾਂ ਇਸ ਤੋਂ ਇਲਾਵਾ ਜੇ ਮੈਂ ਸ਼ੇਡਿੰਗ ਸ਼ੂਡਿੰਗ ਕਰਨੀ ਹੋਏ ਤਾਂ ਉਸ ਲਈ ਫੈਬਰ ਕੈਸਲ ਦਾ ਸ਼ੇਡਿੰਗ ਵਾਲਾ ਯੂਜ ਕਰਦਾ ਹਾਂ ਅਤੇ ਪੇਂਟਿੰਗ ਲਈ ਮੈਂ ਇੱਕ ਕੈਨਵਸ ਲਾਇਆ ਹੋਇਆ ਹੈ ਜੋ ਕਿ ਮੈਂ ਔਨਲਾਈਨ ਮੰਗਵਾਇਆ ਸੀ ਅਤੇ ਇਸ ਦੀ ਕੰਪਨੀ ਵੀ ਫੇਵਰ ਕੈਸਲ ਹੈ ਅਤੇ ਉਸ ਲਈ ਮੈਂ ਕਾਫੀ ਤਰ੍ਹਾਂ ਦੇ ਪੇਂਟ ਬਰਸ਼ ਯੂਜ ਕਰਦਾ ਹਾਂ ਮੇਰੇ ਕੋਲ ਛੇ ਤਰ੍ਹਾਂ ਦੇ ਬਰੱਸ਼ ਹਨ ਇੱਕ ਥੋੜ੍ਹਾ ਪਤਲਾ ਹੈ ਇੱਕ ਆਊਟਲਾਈਨਿੰਗ ਲਈ ਰੱਖਿਆ ਹੈ ਇੱਕ ਮੋ ਥੋੜ੍ਹਾ ਮੋਟਾ ਹੈ ਜਿਸ ਨਾਲ ਵਧੀਆ ਤਰੀਕੇ ਦੀ ਫਿਨਿਸ਼ਿੰਗ ਆਉਂਦੀ ਹੈ ਅਤੇ ਉਸ ਤੋਂ ਇਲਾਵਾ ਸ਼ਾਈਨ ਸ਼ੂਈਨ ਕਰਨ ਲਈ ਵੀ ਇੱਕ ਬਰੱਸ਼ ਮੈਂ ਵੱਖਰਾ ਰੱਖਿਆ ਹੋਇਆ ਹੈ ਅਤੇ ਸ਼ਾਈਨਿੰਗ ਲਈ ਵੀ ਵੱਖਰੇ ਤਰ੍ਹਾਂ ਦੇ ਪੇਂਟ ਯੂਜ ਹੁੰਦੇ ਹਨ ਜਿਹੜੇ ਵਧੀਆ ਤਰੀਕੇ ਨਾਲ ਸਾਈਨ ਲਿਆਉਂਦੇ ਹੈ ਇਸ ਤੋਂ ਇਲਾਵਾ ਉੱਤੋਂ ਲਈ ਮੈਂ ਇੱਕ ਕਵਰ ਵੀ ਰੱਖਿਆ ਜਿਸ ਨਾਲ ਮੇਰੀ ਚਿੱਤਰਕਾਰੀ ਖਰਾਬ ਨਾ ਹੋਵੇ ਅਤੇ ਇਹ ਸਾਰਾ ਸਮਾਨ ਨਾਲ ਲੈਣ ਜਾ ਕੇ ਲੈਣ ਲਈ ਮੈਂ ਇੱਕ ਸਟੈਂਡ ਵੀ ਰੱਖਿਆ ਹੋਇਆ ਇਹ ਸਟੈਂਡ ਦੇ ਵਿੱਚ ਕੈਨਵਸ ਪੇਂਟ ਕਰੀਓਨ ਅਤੇ ਔਰ ਮੇਰੀ ਤਰ੍ਹਾਂ ਦੇ ਵੱਖਰੇ ਕਲਰ ਵੀ ਮੈਂ ਰੱਖ ਸਕਦਾ ਹਾਂ ਇਸ ਦੇ ਨਾਲ ਇੱਕ ਸਟੂਲ ਵੀ ਹੈ ਮੇਰੇ ਕੋਲ